ਹਾਂਜੀ ਭਾਰਤੀ ਵਿਗਿਆਨੀ ਜਿਵੇਂ ਕਿ ਕਲਪਨਾ ਚਾਵਲਾ ਰਕੇਸ਼ ਸ਼ਰਮਾ ਸੁਨੀਤਾ ਵਿਲੀਅਮਸ ਇਹ ਸਾਰੇ ਕੀ ਆ ਜਿਹੜੇ ਇਹਨਾਂ ਨੇ ਆਪਣੇ ਮਤਲਬ ਕਿ ਵਿਗਿਆਨ ਦੇ ਵਿੱਚ ਕੀ ਹੈ ਆਪਣੀ ਕੀ ਹੈ ਉਹ ਪਾਈ ਹੈ ਹਿੱਸੇਦਾਰੀ ਪਾਈ ਹੈ ਉਵੇਂ ਕੀ ਹੈ ਜਿਹੜੇ ਮੈਥਮੈਟਿਕਸ ਦੇ ਕੀ ਨੇ ਬਹੁਤ ਸਾਰੇ ਜਿਹੜੇ ਮਸ਼ਹੂਰ ਕੀ ਹੈ ਸ਼ਾਸ਼ਤਰੀ ਹੋਏ ਨੇ ਜਿਨਾਂ ਜਿਨਾਂ ਦੇ ਵਿੱਚੋਂ ਰਾਮਾਨੰਦ ਜੀ ਅਤੇ ਆਰੀਆ ਭੱਟ ਅਤੇ ਪਾਇਥਾਗੋਰਸ ਜੀ ਨੇ ਜਿਹਨਾਂ ਵਿੱਚੋਂ ਰਾਮਾਨੰਦ ਸੀਗੇ ਜਿਹੜੇ ਉਹ ਕੀ ਆ ਆਪਣੀ ਏਜ ਨਾਲੋਂ ਕਿਤੇ ਹੀ ਮਤਲਬ ਜ਼ਿਆਦਾ ਉਹਨਾਂ ਦੇ ਦਿਲਚਸਪੀ ਵੱਡੀਆਂ ਕਿਤਾਬਾਂ ਲੈ ਕੇ ਉਹ ਕੀ ਹੈ ਸਾਰੇ ਪੜ੍ਹਨ ਗ੍ਰੈਜੂਏਸ਼ਨ ਦੇ ਵਿੱਚ ਵੀ ਆਪ ਤੋਂ ਜਿਹੜੇ ਸੀਨੀਅਰ ਸੀਗੇ ਉਹਨਾਂ ਦੀਆਂ ਸਾਰੀਆਂ ਮੈਥਾਮੈਟਿਕਸ ਦੀਆਂ ਬੁੱਕਸ ਲੈ ਕੇ ਉਹਨਾਂ ਨੇ ਮਤਲਬ ਕਿ ਸਾਰੀਆਂ ਨੂੰ ਸੋਲਵ ਕੀਤਾ ਉਹ ਵੀ ਸ਼ੋਟਕੱਟ ਮੈਥਡ ਨਾਲ ਫਿਰ ਉਹ ਕੀ ਹੈ ਵਿਦੇਸ਼ ਗਏ ਆਪਣੀ ਅਗ ਅਗਲੀ ਪੜਾਈ ਨੂੰ ਪੂਰਾ ਕਰਨ ਲਈ ਅਤੇ ਉੱਥੇ ਕੀ ਆ ਉਹਨਾਂ ਨੇ ਉਥੇ ਵੀ ਉਹਨਾਂ ਨੇ ਟੋਪ ਕੀਤਾ ਅਤੇ ਉਸ ਤੋਂ ਬਾਅਦ ਉਹ ਭਾਰਤ ਆਏ ਅਤੇ ਉਹਨਾਂ ਦੀ ਕੀ ਹੈ ਇੱਕ ਮਤਲਬ ਕਿ ਬਿਮਾਰੀ ਨਾਲ ਕੀ ਆ ਉਹਨਾਂ ਦੀ ਪ੍ਰੋਪਰ ਇਲਾਜ ਨਾ ਹੋਣ ਕਰਕੇ ਉਹਨਾਂ ਦੀ ਕੀ ਆ ਡੈਥ ਹੋ ਗਈ ਐਮੇ ਹੀ ਜਿਹੜੇ ਕਿ ਸਾਇੰਸ ਦੇ ਆਪਾਂ ਸੁ ਕੀ ਹੈ ਕਲਪਨਾ ਚਾਵਲਾ ਜੀ ਬਾਰੇ ਪੜ੍ਹਦੇ ਹਾਂ ਉਹ ਕੀ ਹੈ ਆਪਣੇ ਭਾਰਤ ਦੇ ਪਹਿਲੇ ਪੁਲਾੜ ਮਹਿਲਾ ਯਾਤਰੀ ਬਣੇ ਸੀਗੇ ਜਿਹੜੇ ਕੀ ਹੈ ਪਲਾੜ ਦੇ ਵਿੱਚ ਗਏ ਅਤੇ ਮਤਲਬ ਕਿ ਆਪਾਂ ਨੂੰ ਪੁਲਾੜ ਦੀ ਜਾਣਕਾਰੀ ਦਿੱਤੀ ਅਤੇ ਜਿਸ ਜਿਹੜੇ ਕੀ ਆ ਆਉਂਦੇ ਆਉਂਦੇ ਸੋਲ੍ਹਾਂ ਸੈਕਿੰਡ ਦੀ ਦੂਰੀ 'ਤੇ ਸੀਗੇ ਧਰਤੀ ਤੋਂ ਜਦੋਂ ਕੀ ਹੈ ਉਹਨਾਂ ਦਾ ਜਿਹੜਾ ਪਲੇਨ ਸੀਗਾ ਉਹ ਕਰੈਸ਼ ਹੋ ਗਿਆ ਸੀ ਅਤੇ ਜਿਹਦੇ ਕਰਨ ਉਹਨਾਂ ਦੀ ਕੀ ਹੈ ਡੈੱਥ ਹੋ ਗਈ ਸੀ